ਜੀ ਹਾਂ ਮੈਂ ਬਹੁਤ ਵਾਰ ਡਾਂਸ ਦੇ ਮੁਕਾਬਲੇ ਵਿੱਚ ਹਿੱਸਾ ਲਿਆ ਇਹ ਜਿਹੜਾ ਮੂਮੈਂਟ ਸੀ ਕਾਫੀ ਇੰਜੋਏਫੁਲ ਮੂਮੈਂਟਸ ਸੀ ਮੇਰੇ ਲਈ ਤਾਂ ਕਾਫੀ ਕੁਝ ਗੇਨ ਕਰਨ ਦਾ ਆਪਣੇ ਸੱਭਿਆਚਾਰ ਨਾਲ ਜੁੜਨ ਦਾ ਵੀ ਇੱਕ ਮੌਕਾ ਸੀ ਇਹਦੇ ਵਿੱਚ ਆਪਣੀਆਂ ਡੇਲੀ ਲਾਈਵ ਸਟਰੈਸਸ ਤੋਂ ਥੋੜ੍ਹਾ ਬਹੁਤ ਰਿਲੈਕਸ਼ੇਸ਼ਨ ਆਪਣੇ ਮਾਈਂਡ ਨੂੰ ਰਿਲੈਕਸ ਕਰਨ ਲਈ ਅਤੇ ਆਪਣੇ ਕੋਨਫੀਡੈਂਸ ਨੂੰ ਬਿਲ ਕਰਨ ਵਿੱਚ ਕਾਫੀ ਹੈਲਪਫੁਲ ਸੀ ਮੈਂ ਸਕੂਲ ਟਾਈਮ ਐਨੁਅਲ ਫੰਕਸ਼ਨ ਵਿੱਚ ਪੰਦਰ੍ਹਾਂ ਅਗਸਤ ਦੇ ਮੌਕੇ 'ਤੇ ਅਤੇ ਕੋਲਜ ਵਿੱਚ ਯੂਥ ਫੈਸਟੀਵਲ ਜਾਂ ਪਾਰਟੀ ਵਗੈਰਾ ਨੂੰ ਮੌਕੇ 'ਤੇ ਕਾਫੀ ਵਾਰ ਡਾਂਸ ਮੁਕਾਬਲੇ 'ਚ ਚੱਲਿਆ ਜਿਵੇਂ ਕਲਾਸਿਕਲ ਡਾਂਸ ਭੰਗੜਾ ਗਿੱਧਾ ਆਦਿ ਇਸ ਦੌਰਾਨ ਮੈਨੂੰ ਆਪਣੇ ਸੱਭਿਆਚਾਰ ਨਾਲ ਜੁੜਨ ਦਾ ਮੌਕਾ ਮਿਲਿਆ ਅਤੇ ਟੀਮ ਵਿੱਚ ਰਹਿ ਕੇ ਕਿਸ ਤਰ੍ਹਾਂ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਦਾ ਮੌਕਾ ਮਿਲਿਆ ਟੀਮ ਵਿੱਚ ਕਿੱਦਾਂ ਅਡਜੈਸਟ ਹੋ ਕੇ ਰਹਿਣਾ ਕ ਇਸ ਨਾਲ ਨਿਕੇਟਿਵਿਟੀ ਸਾਫ ਕਾਨਫੀਡੈਂਸ ਹੋਰ ਵੀ ਚੀਜ਼ਾਂ ਦੇ ਵਿੱਚ ਡਵਲਪਮੈਂਟ ਕਰਨ ਲਈ ਇੱਕ ਮੌਕਾ ਮਿਲਿਆ ਇਹਦੇ ਨਾਲ ਫਿਜੀਕਲ ਐਜ ਵੈਲ ਐਜ ਮੈਂਟਲ ਹੈਲਥ ਵੀ ਕਾਫੀ ਇੰਪਰੂਵਮੈਂਟਸ ਦੇਖੀਆਂ ਗਈਆਂ ਜਿਵੇਂ ਫਿਜੀਕਲ ਹੈਲਥ ਆਪਣੀ ਲੰਗਸ ਠੀਕ ਹੈ ਦੀ ਇੰਪਰੂਵਮੈਂਟ ਦੀ ਕੰਡੀਸ਼ਨ ਠੀਕ ਹੈ ਮਸਲ ਸਟਰੈਂਥ ਵਿੱਚ ਵਾਧਾ ਅਜਿਹੀਆਂ ਚੀਜ਼ਾਂ ਦੇਖੀਆਂ ਜਾ ਸਕਦੀਆਂ ਹਨ ਕਿਉਂਕਿ ਡਾਂਸ ਇੱਕ ਤਰ੍ਹਾਂ ਦੀ ਐਕਟੀਵਿਟੀ ਹੈ ਹੈਲਥ ਲਈ ਇੱਕ ਐਕਸਰਸਾਈਜ਼ ਹੈ ਜਿਹੜੀ ਆਪਣੀ ਸਰੀਰਿਕ ਕਿਸ ਤਰ੍ਹਾਂ ਬੈਲੰਸ ਬਣਾ ਕੇ ਰੱਖਣਾ ਠੀਕ ਹੈ ਕਿਸ ਤਰ੍ਹਾਂ ਮੈਨਟੇਨ ਕਰਨਾ ਉਹਦੇ ਵਿੱਚ ਕਾਫੀ ਮਦਦ ਕਰਦਾ ਠੀਕ ਹੈ ਜਿਵੇਂ ਡਾਂਸ ਕਈ ਫੋਮ ਜਿਵੇਂ ਬਿਕਸ ਭੰਗੜਾ ਠੀਕ ਹੈ ਜਿਹੜੀ ਕਿ ਕਾਫੀ ਐਨਰਜੇਟਿਕ ਮੂਵਮੈਂਟਸ ਇਨਵੋਲਵਡ ਹੁੰਦੀਆਂ ਇੱਕ ਤਰ੍ਹਾਂ ਦੇ ਇੱਕ ਵਰਕਆਊਟ ਦਾ ਕੰਮ ਕਰਦੀਆਂ ਪੰਜ ਸੌ ਕੈਲੋਰੀਜ਼ ਜਿਸ ਤਰ੍ਹਾਂ ਕਿ ਆਪਾਂ ਬਰਨ ਕਰ ਸਕਦੇ ਹਾਂ ਪੰਤਾਲੀ ਮਿੰਟ ਦੇ ਸੈਸ਼ਨ ਦੌਰਾਨ ਸੋ ਡਾਂਸ ਇਕ ਅਜਿਹੀ ਗਤੀਵਿਧੀ ਹੈ ਜਿਸ ਨਾਲ ਆਪਣੀ ਜਿਹੜੀ ਫਿਜੀਕਲ ਹੈਲਥ ਐਜ ਵੈਲ ਐਜ ਮੈਂਟਲ ਹੈਲਥ ਵੀ ਦੋਨਾਂ ਲਈ ਬਰਾਬਰ ਬੈਲੰਸ ਬਣਾ ਕੇ ਰੱਖਿਆ ਜਾ ਸਕਦਾ ਸੋ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਡਾਂਸ ਇਜ ਵੈਰੀ ਵੈਰੀ ਗੁਡ ਹੈਲਥੀ ਐਕਸਰਸਾਈਜ ਐਂਡ ਐਵਰੀਵਨ ਸ਼ੁੱਡ ਵੀ ਆ ਪਾਰਟ ਔਫ ਦਿਸ